ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਪਹਿਲਾਂ ਸੋਚਣਾ ਸੀ ਨਾ ਇਹ ਚੀਜ਼ ਜੀ ਅਸੀਂ ਇਹ ਦਕਾਨ ਤੋਂ ਖਰੀਦੀ ਹੋਈ ਚੀਜ਼ ਵਾਪਸ ਨਹੀਂ ਕਰਦੇ ਹਾਂਜੀ

ਠੀਕ ਹੈ ਜੀ ਹਾਂਜੀ ਤੁਸੀਂ ਕੋਈ ਦਕਾਨ ਦਾ ਬਿੱਲ ਜਾਂ ਕਾਰਡ ਲੈ ਗਏ ਸੀ ਨਾਲ ਠੀਕ ਹੈ ਜੀ ਤੁਸੀਂ ਉਹ ਬਿੱਲ ਲੈ ਆਏ ਜੇ ਆਮ ਅਸੀਂ ਚੀਜ਼ ਵਾਪਸ ਨਹੀਂ ਕਰਦੇ ਵੈਸੇ ਤਾਂ ਅ ਤੁਸੀਂ ਇੰਨੇ ਮਾਣ ਨਾਲ ਕਹਿੰਦੇ ਹੋ ਅਸੀਂ ਚੇਂਜ ਕਰ ਦੇਵਾਂਗੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਲੈ ਆਇਆ ਜੇ ਅਤੇ ਆਪਾਂ ਵੇਖ ਕੇ ਜਿਨ ਜਿੰਨੇ ਦੀ ਤੁਹਾਡੀ ਜਿੰਨੀ ਕੀਮਤ ਦੀ ਚੀਜ਼ ਹੈਗੀ ਆ ਉਸ ਉਸ ਓਨੀ ਕੀਮਤ ਦੇ ਨਾਲ ਤੁਹਾਨੂੰ ਬਦਲ ਕੇ ਦੇ ਦੇਵਾਂਗੇ ਚੌਵੀ ਘੰਟੇ ਜੀ ਹੈਂਜੀ ਹਾਂਜੀ ਆਮ ਕਰਕੇ ਦੁਕਾਨਦਾਰ ਦ ਬਾਰਾਂ ਵਜੇ ਤੋਂ ਬਾਅਦ ਹੀ ਸਮਾਨ ਵਾਪਸ ਕਰਦੇ ਹੈ ਪਹਿਲਾਂ ਉਹਨਾਂ ਦਾ ਬੋਣੀ ਦਾ ਟੈਮ ਹੁੰਦਾ ਉਹ ਮੰਨਦੇ ਨੇ ਇਸ ਕਰਕੇ ਪਹਿਲਾਂ ਨਹੀਂ ਵਾਪਸ ਕਰਦੇ ਚੀਜ਼ ਬਾਅਦ ਵਿੱਚ ਉਹ ਕਰ ਦਿੰਦੇ ਨੇ ਹਾਂਜੀ ਫਿਰ ਅਸੀਂ ਕਰ ਲਵਾਂਗੇ ਜੀ ਹੋਰ ਹੋਰ ਕੋਈ ਸੇਵਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਕੋਈ ਗੱਲ ਸਾਡੀ ਦੁਕਾਨ 'ਤੇ ਹਰ ਤਰ੍ਹਾਂ ਦਾ ਸਮਾਨ ਹੁੰਦਾ ਹੈ ਜੀ ਹਾਂਜੀ ਹਾਂਜੀ ਕੁਰਸੀਆਂ ਸਟੱਡੀ ਟੇਬਲ ਮੇਜ ਬੈੱਡ ਅਲਮਾਰੀਆਂ ਸਭ ਚੀਜ਼ ਹੁੰਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਵੀ ਹੁੰਦੀਆਂ ਜੀ ਹਾਂਜੀ ਬੈੱਡ ਟੇਬਲ ਬੈੱਡ ਟੇਬਲ ਹੁੰਦਾ ਹੈ ਜੀ ਉਹ ਹਾਂਜੀ ਹਾਂਜੀ ਹੁੰਦਾ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਜੀ